ਮੇਰੀ ਹੁਣ ਤੋਂ ਸਭ ਤੋਂ ਸੁੰਦਰ ਯਾਤਰਾ ਵੈਸ਼ਨੋ ਦੇਵੀ ਦੀ ਹੈ ਮੈਂ ਵੈਸ਼ਨੋ ਦੇਵੀ ਗਈ ਸੀ ਅੱਜ ਤੋਂ ਦੋ ਤਿੰਨ ਸਾਲ ਪਹਿਲਾਂ ਮੈਂ ਵੈਸ਼ਨੋ ਦੇਵੀ ਮਾਤਾ ਦੇ ਮੰਦਰ ਗਈ ਸੀ ਜੋ ਕਿ ਮੇਰਾ ਬਹੁਤ ਵਧੀਆ ਐਕਪੀਰੀਅੰਸ ਸੀ ਅਤੇ ਮੇਰੀ ਬਹੁਤ ਸੁੰਦਰ ਯਾਤਰਾ ਸੀ ਉੱਥੇ ਜਾ ਕੇ ਅਸੀਂ ਕਾਫੀ ਵਧੀਆ ਸਾਨੂੰ ਦਰਸ਼ਨ ਹੋਏ ਅਸੀਂ ਇੱਥੋਂ ਪਹਿਲੇ ਅੰਮ੍ਰਿਤਸਰ ਤੋਂ ਬੱਸ ਲਿਤੀ ਅਸੀਂ ਕੱਟਰੇ ਤੱਕ ਗਏ ਕੱਟਰੇ ਤੋਂ ਬਾਅਦ ਅਸੀਂ ਉੱਥੇ ਜਾ ਕੇ ਇਸ਼ਨਾਨ ਕੀਤਾ ਇਸ਼ਨਾਨ ਕਰਨ ਤੋਂ ਬਾਅਦ ਅਸੀਂ ਯਾਤਰਾ ਸ਼ੁਰੂ ਕੀਤੀ ਪੈਦਲ ਹੀ ਪੈਦਲ ਜਾ ਕੇ ਅਸੀਂ ਜਦੋਂ ਅਸੀਂ ਪੈਦਲ ਜਾਂਦੇ ਰਹੇ ਉਹ ਜਾਂਦੇ ਰਹੇ ਫਿਰ ਉਹ ਉਸ ਤੋਂ ਬਾਅਦ ਅੱਧ ਕਵਾਰੀ ਵਿਚਕਾਰ ਗਰਭ ਜੂਨ 'ਤੇ ਜਾ ਕੇ ਅਸੀਂ ਰਸ਼ ਉੱਥੇ ਅਸੀਂ ਜਾ ਕੇ ਰੈਸਟ ਥੋੜ੍ਹਾ ਵਿਰਾਮ ਕੀਤਾ ਉੱਥੇ ਅੱਧ ਕਵਾਰੀ 'ਚ ਅਸੀਂ ਬ੍ਰੇਕ ਲਿਤੀ ਉੱਥੇ ਅਸੀਂ ਕੁਛ ਖਾਧਾ ਪੀਤਾ ਅਤੇ ਨਾਲ ਥੋੜ੍ਹੀ ਰੈਸਟ ਕੀਤੀ ਫਿਰ ਅਸੀਂ ਦੁਬਾਰਾ ਤੋਂ ਯਾਤਰਾ ਸ਼ੁਰੂ ਕੀਤੀ ਅਸੀਂ ਫਿਰ ਅ ਯਾਤਰਾ ਸ਼ੁਰੂ ਕਰਨ ਤੋਂ ਬਾਅਦ ਅਸੀਂ ਪੈਦਲ ਹੀ ਯਾਤਰਾ ਸ਼ੁਰੂ ਕਰਦੇ ਰਹੇ ਅਤੇ ਭਵਨ 'ਚ ਅਸੀਂ ਪਹੁੰਚੇ ਰਾਤ ਦੇ ਕੁਛ ਨੌਂ ਦਸ ਵਜੇ ਅਸੀਂ ਉੱਥੇ ਪਹੁੰਚੇ ਉੱਥੇ ਜਾ ਉੱਥੋਂ ਦੇ ਫੇਮਸ ਅਸੀਂ ਰਾਜਮਾਂਹ ਚਾਵਲ ਖਾਧੇ ਜੋ ਕਿ ਬਹੁਤ ਵਧ ਯ ਵਧੀਆ ਸੀ ਸੁਆਦ ਸੀ ਅਤੇ ਅਸੀਂ ਉੱਥੋਂ ਫਿਰ ਉਸ ਤੋਂ ਬਾਅਦ ਅਸੀਂ ਦੁਬਾਰਾ ਇਸ਼ਨਾਨ ਕੀਤਾ ਅਤੇ ਅਸੀਂ ਭਗਵਾਨ ਦੇ ਦਰਸ਼ਨ ਕੀਤੇ ਕਾਫੀ ਲੰਬੀ ਲਾਈਨ ਸੀ ਪਰ ਸਾਨੂੰ ਰਾਤ ਦੇ ਦੋ ਤਿੰਨ ਵਜੇ ਦਰਸ਼ਨ ਬਹੁਤ ਵਧੀਆ ਹੋ ਗਏ ਇੰਨਾ ਵਧੀਆ ਅ ਦਰਸ਼ਨ ਹੋਏ ਨਾ ਸਾਨੂੰ ਉੱਥੇ ਰਾਤੀਂ ਲਾਈਨ ਸੀ ਪਰ ਰਸ਼ ਵੀ ਬਹੁਤ ਸੀ ਪਰ ਫਿਰ ਵੀ ਬਹੁਤ ਵਧੀਆ ਦਰਸ਼ਨ ਹੋ ਗਏ ਰਾਤ ਦੇ ਦੋ ਤਿੰਨ ਵਜੇ ਉਸ ਤੋਂ ਬਾਅਦ ਅਸੀਂ ਫਿਰ ਉੱਤੇ ਭੈਰੋਘਾਟੀ ਗਏ ਭੈਰੋਘਾਟੀ ਜਾਣ ਵਾਲੇ ਵੀ ਅਸੀਂ ਪੈਦਲ ਰਹੇ ਪੈਦਲ ਹੀ ਸਫ਼ਰ ਸ਼ੁਰੂ ਕੀਤਾ ਆਪਣਾ ਪੈਦਲ ਗਏ ਸਵੇਰ ਦੇ ਪੰਜ ਛੇ ਵਜੇ ਉਸ ਜਦੋਂ ਅਸੀਂ ਉੱਥੇ ਪਹੁੰਚੇ ਅਤੇ ਭੈਰੋਘਾਟੀ ਦੇ ਅਸੀਂ ਦਰਸ਼ਨ ਕੀਤੇ ਅਤੇ ਬਹੁਤ ਵਧੀਆ ਦਰਸ਼ਨ ਹੋਏ ਸਾਨੂੰ ਉੱਥੇ ਜਦੋਂ ਅਸੀਂ ਪਹੁੰਚੇ ਤਾਂ ਸਨਰਾਈਜ਼ ਹੁੰਦਾ ਪਿਆ ਸੀ ਅਤੇ ਉੱਤੋਂ ਅਸੀਂ ਅ ਸੂਰਜ ਉਦ ਉੱਗਦਾ ਪਿਆ ਸੀ ਅਤੇ ਬਹੁਤ ਵਧੀਆ ਨਜ਼ਾਰਾ ਸੀ ਸਾਨੂੰ ਸੂਰਜ ਦਾ ਅਤੇ ਅਸੀਂ ਉਹਨੂੰ ਦੇਖਿਆ ਅਤੇ ਬਹੁਤ ਉਹ ਸਾਨੂੰ ਵਧੀਆ ਲੱਗਿਆ ਉੱਥੇ ਅਸੀਂ ਪਿਚਰਸ ਲੀ ਫੋਟੋਆਂ ਖਿੱਚੀਆਂ ਅਤੇ ਫੋਟੋਆਂ ਖਿੱਚਣ ਤੋਂ ਬਾਅਦ ਅਸੀਂ ਦੇਖਿਆ ਅਤੇ ਸਾਨੂੰ ਬਹੁਤ ਵਧੀਆ ਮਜ਼ਾ ਵੀ ਆਇਆ ਉਸ ਤੋਂ ਬਾਅਦ ਅਸੀਂ ਫਿਰ ਉਤਰਾਈ ਸ਼ੁਰੂ ਕਰ ਲਈ ਉੱਥੋਂ ਅਸੀਂ ਉਤਰਾਈ ਸ਼ੁਰੂ ਕੀਤੀ ਅਤੇ ਦੁਪਹਿਰ ਦੇ ਦੋ ਤਿੰਨ ਵਜੇ ਅਸੀਂ ਨੀਚੇ ਆਏ ਉਸ ਤੋਂ ਬਾਅਦ ਅਸੀਂ ਫਿਰ ਬੱਸ ਫੜੀ ਅਤੇ ਅਸੀਂ ਅੰਮ੍ਰਿਤਸਰ ਆਏ ਉਹ ਯਾਤਰਾ ਸਾਡੀ ਸਭ ਤੋਂ ਵਧੀਆ ਯਾਤਰਾ ਸੀ ਅਤੇ ਵਧੀਆ ਸੀ ਅਤੇ ਸਾਨੂੰ ਬਹੁਤ ਮਜ਼ਾ ਆਇਆ ਸੀ ਸਾਨੂੰ ਬਹੁਤ ਵਧੀਆ ਦਰਸ਼ਨ ਹੋਏ ਸੀ ਮਾਤਾ ਜੀ ਦੇ ਅਤੇ ਬਹੁਤ ਵਧੀਆ ਸੀ ਧੰਨਵਾਦ